ਉਸ ਵਿਅਕਤੀ ਲਈ ਇਹੀ ਸਲਾਹ ਹੈ ਕਿ ਤੈਰਨਾ ਸਿੱਖਣਾ ਬਹੁਤ ਹੀ ਚੰਗੀ ਗੱਲ ਹੈ ਇਸ ਨਾਲ ਲੋਕਾਂ ਦੀ ਮਦਦ ਤਾਂ ਹੁੰਦੀ ਹੀ ਹੁੰਦੀ ਹੈ ਇਸ ਨਾਲ ਪੈਸਾ ਵੀ ਕਮਾਇਆ ਜਾ ਸਕਦਾ ਹੈ ਜਿਸ ਨਾਲ ਆਪਣੀ ਰੋਜ਼ੀ ਰੋਟੀ ਚੱਲਦੀ ਹੈ ਅੱਜ ਕੱਲ੍ਹ ਸੰਸਾਰ ਵਿੱਚ ਪੈਸਾ ਸਭ ਤੋਂ ਬਹੁਤ ਵੱਡੀ ਚੀਜ਼ ਹੈ ਤੈਰਾਕੀ ਤੈਰਨਾ ਇੱਕ ਬਹੁਤ ਵੱਡੀ ਗੇਮ ਹੈ ਜੋ ਕਿ ਦੁਨੀਆ ਭਰ ਵਿਖੇ ਮਸ਼ਹੂਰ ਹੈ ਤੈਰਨ ਨਾਲ ਕੀ ਹੁੰਦਾ ਹੈ ਕਿ ਮੰਨ ਲਉ ਕੋਈ ਅਚਨਚੇਤ ਵਿਅਕਤੀ ਨਹਿਰ ਵਿੱਚ ਜਾਂ ਸਮੁੰਦਰ ਵਿੱਚ ਡਿੱਗ ਗਿਆ ਜਿਸ ਨੂੰ ਤੈਰਨਾ ਨਹੀਂ ਆਉਂਦਾ ਤਾਂ ਜਿਹੜੇ ਵਿਅਕਤੀ ਨੂੰ ਤੈਰਨਾ ਆਉਂਦਾ ਹੈ ਉਹ ਉਸ ਨੂੰ ਉਸ ਨਹਿਰ ਵਿੱਚੋਂ ਜਾਂ ਸਮੁੰਦਰ ਵਿੱਚੋਂ ਕੱਢ ਲਿਆਵੇਗਾ ਕਈ ਵਾਰ ਉਹ ਆਪ ਹੀ ਇਨਸਾਨ ਅਚਨਚੇਤ ਸਮੁੰਦਰ ਵਿੱਚ ਜਾਂ ਨਹਿਰ ਵਿੱਚ ਡਿੱਗ ਜਾਂਦਾ ਹੈ ਤਾਂ ਉਸਨੂੰ ਕੋਈ ਡਰ ਜਾਂ ਖਤਰਾ ਨਹੀਂ ਕਿਉਂਕਿ ਉਸਨੂੰ ਤੈਰਨਾ ਆਉਂਦਾ ਹੈ ਉਹ ਆਪਣੇ ਆਪ ਬਾਹਰ ਨਿਕਲ ਆਵੇਗਾ ਇਸ ਲਈ ਉਸ ਵਿਅਕਤੀ ਨੂੰ ਇਹੀ ਸਲਾਹ ਹੈ ਕਿ ਉਸਨੂੰ ਤੈਰਨਾ ਸਿੱਖਣਾ ਸਿੱਖਣਾ ਚਾਹੀਦਾ ਹੈ ਅਤੇ ਬਹੁਤ ਹੀ ਲਗਨ ਦੇ ਨਾਲ ਸਿੱਖਣਾ ਚਾਹੀਦਾ ਹੈ ਮਿਹਨਤ ਨਾਲ ਤੈਰਾਕੀ ਇੱਕ ਗੇਮ ਹੈ ਤੈਰਨ ਨਾਲ ਬਹੁਤ ਹੀ ਵਧੀਆ ਹੁੰਦਾ ਹੈ ਜੋ ਕਿ ਵਧੀਆ ਸਿਸਟਮ ਹੈ